ਅੱਜ ਕੱਲ੍ਹ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਐਪਾਂ ਜਿੱਦਾਂ ਕਿ ਸਨੈਪਚੈਟ ਹੈ ਯੂਟਿਊਬ ਹੈ ਵਟ੍ਹਸਐਪ ਹੈ ਗੈਮਜ਼ ਇੰਸਟਾਗ੍ਰਾਮ ਹੋਰ ਵੀ ਬਹੁਤ ਸਾਰੀਆਂ ਐਪਾਂ ਜਿਹੜੇ ਨੇ ਲੋਕ ਜ਼ਿਆਦਾ ਯੂਸ ਕਰਦੇ ਆ ਪਰ ਇਹ ਫੋਨ ਦੇ ਨਾ ਫਾਇਦੇ ਵੀ ਬਹੁਤ ਹੈ ਅਤੇ ਨੁਕਸਾਨ ਵੀ ਬਹੁਤ ਹੈ ਪਹਿਲਾਂ ਆਪਾਂ ਇਹਨਾਂ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਫਾਇਦੇ ਇਹ ਹੈ ਕਿ ਅਸੀਂ ਆਪਣੇ ਕਿਸੇ ਦੂਰ ਬੈਠੇ ਨਾਲ਼ ਜਦੋਂ ਮਰਜ਼ੀ ਦਿਲ ਕਰੇ ਗੱਲ ਕਰ ਸਕਦੇ ਹਾਂ ਭਾਵੇਂ ਰਾਤ ਨੂੰ ਕਰੋ ਭਾਵੇਂ ਦਿਨ ਨੂੰ ਕਰੋ ਔਰ ਕਿਸੇ ਦੂਰ ਬੈਠੇ ਨੂੰ ਦੇਖਣ ਦਾ ਦਿਲ ਕਰਦਾ ਹੈ ਤਾਂ ਅਸੀਂ ਉਹਨੂੰ ਵੀਡੀਓ ਕਾਲ ਵੀ ਕਰ ਸਕਦੇ ਹਾਂ ਨੁਕਸਾਨ ਇਹਦੇ ਇਹ ਹੈ ਕਿ ਬੱਚਿਆਂ 'ਤੇ ਇਸ ਦਾ ਗਲਤ ਅਸਰ ਪੈ ਰਿਹਾ ਬੱਚੇ ਹੁਣ ਬਾਹਰ ਨਹੀਂ ਖੇਡਣ ਜਾਂਦੇ ਉਹਨਾਂ ਨੂੰ ਸਾਰਾ ਦਿਨ ਫੋਨ ਚਾਹੀਦਾ ਫੋਨ ਲੈ ਕੇ ਇੱਕ ਕੋਨੇ 'ਚ ਬੈਠੇ ਗੇਮ ਖੇਡੀ ਜਾ ਰਹੇ ਆ ਤਾਂ ਕੁਛ ਵੀ ਗਲਤ ਵੀ ਦੇਖ ਸਕਦੇ ਆ ਮਾਂ ਬਾਪ ਦੀਆਂ ਅੱਖਾਂ ਤੋਂ ਚੋਰੀ ਉਹ ਬੈਠ ਕੇ ਇਹ ਹੁੰਦਾ ਵੀ ਕੁਛ ਗਲਤ ਨਾ ਕੱਢ ਕੇ ਫੋਨ ਵਿੱਚ ਦੇਖ ਲੈਣ ਇਸ ਕਰਕੇ ਨਾ ਉਹਨਾਂ ਦੇ ਬੱਚਿਆਂ ਦੇ ਦਿਮਾਗ ਦਾ ਨਾ ਵਿਕਾਸ ਨਹੀਂ ਹੋ ਰਿਹਾ ਪੂਰਾ ਉਹ ਫੋਨ ਤੱਕ ਹੀ ਸੀਮਤ ਰਹਿ ਗਏ ਹੈ ਉਹਨਾਂ ਨੂੰ ਭਾਵੇਂ ਰੋਟੀ ਮਿਲੇ ਨਾ ਮਿਲੇ ਤਾਂ ਹਰ ਟਾਈਮ ਫੋਨ ਹੱਥ ਵਿੱਚ ਚਾਹੀਦਾ ਆਪਸ ਵਿੱਚ ਵੀ ਮਾਂ ਬਾਪ ਨਾਲ ਵੀ ਨਹੀਂ ਗੱਲ ਕਰਨਗੇ ਬੱਸ ਫੋਨ ਚਾਹੀਦਾ ਉਹਨਾਂ ਨੂੰ ਇਸ ਗੱਲ ਦਾ ਇਹਦਾ ਨੁਕਸਾਨ ਵੀ ਫੋਨ ਫੋਨ ਦੇ ਜ਼ਿਆਦਾ ਹੈ ਜਿੱਥੇ ਇਹਦੇ ਫਾਇਦੇ ਤਾਂ ਨੁਕਸਾਨ ਵੀ ਬਹੁਤ ਹੈ